ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਬਹੁਤ ਸਾਰੇ ਮੀਡੀਆ ਦੇ ਦਫਤਰ ਨੇ ਅਤੇ ਇੱਥੇ ਫਤਿਹਗੜ੍ਹ ਸਾਹਿਬ 'ਚ ਫਤਿਹਗੜ ਟੂਡੇ ਦੇ ਨਾਮ 'ਤੇ ਇੱਕ ਅਖਬਾਰ ਵੀ ਹੈ ਅਤੇ ਆਪਣਾ ਜ਼ਿਲ੍ਹੇ 'ਚ ਪੂਰਾ ਜਿਹੜਾ ਖਬਰਾਂ ਦਾ ਉਹ ਹੁੰਦਾ ਚੈਨਲ ਵੀ ਹੈਗਾ ਅਤੇ ਸਾਨੂੰ ਇਹਦੀਆਂ ਸਫਾਈਆਂ ਵਗੈਰਾ ਜਾਂ ਹੋਰ ਆਲੇ ਦੁਆਲੇ ਦੀਆਂ ਸਾਰੀਆਂ ਖਬਰਾਂ ਨਿਊਜ਼ ਨਿਊਜ਼ 'ਚ ਮਿਲਦੀਆਂ ਰਹਿੰਦੀਆਂ ਨੇ ਅਤੇ ਆਲੇ ਦੁਆਲੇ ਜਿਨ੍ਹਾਂ ਲੋਕਾਂ ਕੋਲ ਅਖਬਾਰ ਆਉਂਦਾ ਜਾਂ ਟੀ ਵੀ ਦੇ ਵਿੱਚ ਵੀ ਚੈਨਲ 'ਚ ਸਾਡੇ ਰਿਪੋਰਟਰ ਜਿਹੜੇ ਪ੍ਰੈੱਸ ਆ ਉਹ ਸਾਰੀਆਂ ਖਬਰਾਂ ਉਹਦੇ ਜ਼ਰੀਏ ਦਿੰਦੇ ਰਹਿੰਦੇ ਨੇ ਅਤੇ ਅਤੇ ਸਾਰੇ ਜਿਵੇਂ ਕਿ ਸਾਡੇ ਫਤਿਹਗੜ੍ਹ ਸਾਹਿਬ 'ਚ ਜਗ੍ਹਾ ਜਗ੍ਹਾ 'ਤੇ ਆਹ ਹੁਣ ਹੜ੍ਹ ਆਏ ਸੀਗੇ ਅਤੇ ਉਹ ਹੜ੍ਹ ਦੀ ਜਾਣਕਾਰੀ ਵੀ ਸਾਨੂੰ ਪਹਿਲਾਂ ਪਤਾ ਚੱਲ ਗਈ ਸੀ ਕੁਛ ਟਾਈਮ ਤਾਂ ਕਿ ਅਸੀਂ ਆਪਣੇ ਸੁਚੇਤ ਹੋ ਸਕੇ ਅਤੇ ਆਪਣਾ ਸਮਾਨ ਕੀਮਤੀ ਸਮਾਨ ਸੀਗਾ ਜਿਹੜਾ ਸਾਂਭ ਸਕੇ ਸਾਡੇ ਜਿਵੇਂ ਮੀਡੀਆ ਨੂੰ ਇੱਕ ਚੀਜ਼ ਹੋਰ ਮਤਲਬ ਕਹਿਣ ਦੀ ਜ਼ਰੂਰਤ ਹੈ ਜਿਹੜੀ ਕਿ ਆਪਣੇ ਸਾਡੇ ਇੱਥੇ ਚੋਆ ਲੰਘਦਾ ਹੈ ਜਿਹਨੂੰ ਪਹਿਲਾਂ ਪੁਰਾਣੀ ਨਦੀ ਵੀ ਕਿਹਾ ਜਾਂਦਾ ਸੀਗਾ ਅਤੇ ਉਹ ਹੁਣ ਚੋਏ ਦੇ ਰੂਪ 'ਚ ਇੱਥੇ ਉਹਦੇ ਵਿੱਚ ਸਾਰੀ ਸ਼ਹਿਰ ਦੀ ਗੰਦਗੀ ਜਾਂਦੀ ਹੈ ਅਤੇ ਉਸ ਵੱਲ ਮੀਡੀਆ ਨੂੰ ਖਾਸ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਤਾਂ ਕਿ ਇਹ ਆਪਣਾ ਜਿਹੜੇ ਇੱਥੇ ਚੁਣੀਦੀ ਨੁਮੀਦੇ ਨੇ ਉਹਨਾਂ ਅੱਗੇ ਇਹ ਚੀਜ਼ ਰੱਖ ਸਕੀਏ ਅਤੇ ਤਾਂ ਜੋ ਉਹਨਾਂ ਦੀ ਸਫਾਈ ਵਗੈਰਾ ਸਾਰਾ ਕੁਛ ਵੱਲ ਧਿਆਨ ਦਿੱਤਾ ਜਾ ਸਕੇ ਇਹ ਬਹੁਤ ਪਵਿੱਤਰ ਜਗ੍ਹਾ ਹੈ ਫਤਿਹਗੜ੍ਹ ਸਾਹਿਬ ਦੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਅਤੇ ਇਹਦੇ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਸਾਡੀ ਆਪਣੀ ਜਿੰਮੇਵਾਰੀ